ਹੈਲੋ ਹਾਂਜੀ ਹਾਂਜੀ ਨਮਸਤੇ ਜੀ ਹਾਂਜੀ ਹਾਂਜੀ ਜੀ ਆਇਆਂ ਨੂੰ ਹਾਂਜੀ ਹਾਂਜੀ ਆਓ ਤੁਸੀਂ ਤੁਹਾਨੂੰ ਸੂਟ ਕਦੋਂ ਚਾਹੀਦਾ ਚਲੋ ਕੋਈ ਨਹੀਂ ਤੁਸੀਂ ਸਾਨੂੰ ਨਾ ਆਪਣਾ ਨਾਪ ਦੇ ਦਿਓ ਹਾਂਜੀ ਨਾਪ ਲਿਖਾ ਦਿਉ ਆਪਣਾ ਪੂਰਾ ਅਤੇ ਫਿਰ ਤੁਹਾਨੂੰ ਅਸੀਂ ਸੂਟ ਸੀ ਦਿੰਦੇ ਹਾਂ ਹਾਂਜੀ ਨਾਪ ਤੁਸੀਂ ਬੋਲੋ ਨਾ ਅਸੀਂ ਇੱਦਾਂ ਹੀ ਲਿਖ ਲੈਂਦੇ ਹਾਂ ਨਾ ਹਾਂਜੀ ਸ਼ਰਟ ਦੀ ਲੈਂਥ ਕਮੀਜ਼ ਦੀ ਲੰਬਾਈ ਬੋਲੋ ਕਿੰਨੀ ਹੈ ਹਾਂਜੀ ਛਾਤੀ ਹਾਂਜੀ ਕਮਰ ਠੀਕ ਹੈ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਜਦੋਂ ਤੁਸੀਂ ਕਹੋ ਉਦੋਂ ਹੀ ਸੀ ਦੇਵਾਂਗੇ ਤੁਸੀਂ ਬੋਲੋ ਕਦੋਂ ਚਾਹੀਦਾ ਠੀਕ ਹੈ ਜੀ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਤੁਹਾਡੇ ਕੋਲੋਂ ਅਸੀਂ ਜ਼ਿਆਦਾ ਥੋੜ੍ਹੀ ਲੈਣੀ ਹੈ ਸਵਾਈ ਘੱਟ ਹੀ ਲਵਾਂਗੇ ਤੁਹਾਡੇ ਕੋਲੋਂ ਸਵਾਈ ਹਾਂਜੀ ਕੋਈ ਨਹੀਂ ਤੁਸੀਂ ਆਇਓ ਆ ਕੇ ਦੇਖ ਲਿਓ ਨਾ ਘੱਟ ਹੀ ਲਵਾਂਗੇ ਸਵਾਈ ਜ਼ਿਆਦਾ ਨਹੀਂ ਲਵਾਂਗੇ ਠੀਕ ਹੈ ਠੀਕ ਹੈ